ਕੈਪਟਨ ਵਿਕਰਮ ਬਤਰਾ ਸ਼ਹੀਦ ਭਗਤ ਸਿੰਘ ਪੀ ਐਮ ਨਰਿੰਦਰ ਮੋਦੀ ਡਾਕਟਰ ਰਜਿੰਦਰ ਪ੍ਰਸਾਦ ਲੇਟ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਪ੍ਰੈਸੀਡੈਂਟ ਦਰੋਪਦੀ ਮੁਰਮੁਰ ਡਾਕਟਰ ਅਬਦੁਲ ਕਲਾਮ ਡਾਕਟਰ ਬੀ ਆਰ ਅੰਬੇਦਕਰ ਮੇਜਰ ਵਿਸ਼ਾਲ ਕੁਮਾਰ ਡਾਕਟਰ ਰਬਿੰਦਰਨਾਥ ਟੈਗੋਰ ਲੇਟ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਮਹਾਤਮਾ ਗਾਂਧੀ ਵਾਈਸ ਪ੍ਰੈਸੀਡੈਂਟ ਜਗਦੀਪ ਧਨਖੜ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਚੀਫ ਆਫ ਆਰਮੀ ਮਨਿਸਟ ਮੇਜਰ ਪਾਂਡੇ ਡਾਕਟਰ ਸੁਧਾ ਮੂਰਤੀ ਧੰਨਵਾਦ